ਹੈਲੋ ਬਾਲਾ ਜੀ ਆਟੋ ਸਰਵਿਸ ਤੋਂ ਬੋਲਦੇ ਹੋ ਅਸੀਂ ਇੱਕ ਗੱਡੀ ਬੁੱਕ ਕਰਵਾਈ ਸੀ ਤੁਹਾਡੇ ਕੋਲੋਂ ਅੰਮ੍ਰਿਤਸਰ ਜਾਣ ਵਾਸਤੇ ਤੁਹਾਡਾ ਡਰਾਈਵਰ ਆਇਆ ਨਹੀਂ ਅਸੀਂ ਤਾਂ ਬਹੁਤ ਦੇਰ ਤੋਂ ਉਡੀਕ ਰਹੇ ਹਾਂ ਸਾਡਾ ਸਾਰਾ ਹੀ ਪ੍ਰੋਗਰਾਮ ਖਰਾਬ ਹੋ ਗਿਆ ਅਸੀਂ ਰਸਤੇ ਚੋਂ ਆਪਣੇ ਰਿਸ਼ਤੇਦਾਰ ਵੀ ਲੈਣੇ ਸੀ ਉਹ ਵੀ ਉੱਥੇ ਖੜ੍ਹੇ ਉਡੀਕੀ ਜਾਂਦੇ ਆ ਗਰਮੀ ਦੇ ਵਿੱਚ ਹੁਣ ਸਾਨੂੰ ਦੱਸੋ ਵੀ ਟਾਈਮ 'ਤੇ ਅਸੀਂ ਕੀ ਆਪਣਾ ਅਰੇਂਜਮੈਂਟ ਕਰੀਏ ਵੀ ਤੁਹਾਡਾ ਡਰਾਈਵਰ ਵਾਲਾ ਕੰਮ ਸਹੀ ਨਹੀਂ ਗਾ ਤੁਹਾਨੂੰ ਇਹ ਜਿੰਮੇਵਾਰੀ ਲੈਣੀ ਚਾਹੀਦੀ ਹੈ ਜਦੋਂ ਤੁਸੀਂ ਸਾਡੇ ਤੋਂ ਪੈਸੇ ਲੈ ਲਏ ਅਤੇ ਫਿਰ ਸਾਨੂੰ ਟਾਈਮ ਸਿਰ ਕਿਉਂ ਨਹੀਂ ਦਿੱਤਾ ਅਸੀਂ ਅੱਗੋਂ ਜਾ ਕੇ ਦੂਜਾ ਹਵਾਈ ਜਹਾਜ਼ ਦੀਆਂ ਟਿਕਟਾਂ ਵੀ ਸਾਡੀਆਂ ਬੁੱਕ ਸੀ ਸਾਡੀਆਂ ਉਹ ਵੀ ਰਹਿ ਗਈਆਂ ਜਦੋਂ ਅਸੀਂ ਲੇਟ ਹੋ ਗਏ ਹੁਣ ਦੱਸੋ ਅਸੀਂ ਇਹ ਜਿਹੜਾ ਖਰਚਾ ਆਪਣਾ ਤੁਹਾਡਾ ਕਿਹਦੇ ਸਿਰ ਪਾਈਏ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੁਹਾਨੂੰ ਘੱਟ ਤੋਂ ਘੱਟ ਜੇ ਤੁਹਾਡੇ ਕੋਲ ਡਰਾਈਵਰ ਨਹੀਂ ਸੀ ਤੁਸੀਂ ਸਾਨੂੰ ਪਹਿਲਾਂ ਹੀ ਦੱਸ ਦੇਣਾ ਸੀ ਅਸੀਂ ਕੋਈ ਆਪਣਾ ਹੋਰ ਅਰੇਂਜਮੈਂਟ ਕਰਦੇ ਹੁਣ ਅਸੀਂ ਐਡੀ ਛੇਤੀ ਤਾਂ ਕੋਈ ਹੋਰ ਗੱਡੀ ਵੀ ਨਹੀਂ ਲੱਭ ਸਕਦੇ ਗੇ ਅਤੇ ਦੱਸੋ ਫਿਰ ਹੁਣ ਸਾਡੇ ਕੋਲ ਕੀ ਹੱਲ ਹੈ ਇਹਦੀ ਜਿੰਮੇਵਾਰੀ ਹੁਣ ਤੁਹਾਡੀ ਬਣਦੀ ਹੈ ਦੱਸੋ ਤੁਸੀਂ ਕੀ ਕਰੋਂਗੇ